ਪਹਿਲਾਂ ਵਾਲੇ ਸਮੇਂ 'ਚ ਤਾਂ ਕਿਤਾਬਾਂ ਵਿੱਚ ਵੀ ਬਹੁਤ ਕੁਝ ਹੁੰਦਾ ਸੀ ਬਟ ਅੱਜ ਦੇ ਜ਼ਮਾਨੇ ਵਿੱਚ ਕਿਤਾਬਾਂ ਦੇ ਨਾਲ ਨਾਲ ਇਲੈਕਟ੍ਰੋਨਿਕ ਸੰਸਕਾਰਨਾਂ ਜਿਵੇਂ ਮੋਬਾਈਲ ਲੈਪਟੋਪ ਅ ਟੀ ਵੀ ਵਗੈਰਾ ਵੀ ਆ ਚੁੱਕੇ ਹਨ ਇੱਕ ਬੱਚੇ ਨੂੰ ਪਹਿਲਾਂ ਤਾਂ ਪੜ੍ਹਨ ਟਾਈਮ ਕਿਤਾਬ ਚੱਕਣੀ ਪੈਂਦੀ ਸੀ ਬਟ ਅੱਜ ਕੱਲ੍ਹ ਦਾ ਟਾਈਮ ਇੱਦਾਂ ਦਾ ਆ ਗਿਆ ਹੈ ਕਿ ਅ ਕਿਤਾਬਾਂ ਦਾ ਸਾਰਾ ਹੀ ਅ ਮਟੀਰੀਅਲ ਸਾਡੇ ਮੋਬਾਇਲ ਫੋਨਾਂ 'ਤੇ ਆ ਚੁੱਕਿਆ ਹੈ ਜਿਵੇਂ ਕਿ ਗੂਗਲ ਅ ਯੂਟਿਊਬ ਅਸੀਂ ਕੋਈ ਵੀ ਟੋਪਿਕ ਸਰਚ ਕਰਕੇ ਗੂਗਲ 'ਤੇ ਉਸੇ ਟਾਈਮ ਉਸਨੂੰ ਕੱਢ ਸਕਦੇ ਹਾਂ ਅਤੇ ਪੜ੍ਹ ਸਕਦੇ ਹਾਂ ਅਤੇ ਆਪਣੇ ਜਿਹੜੇ ਡਾਊਟ ਹੈ ਉਹਨਾਂ ਨੂੰ ਕਲੀਅਰ ਕਰ ਸਕਦੇ ਹਾਂ ਜਿਵੇਂ ਜਿਵੇਂ ਕਿ ਅੱਗੇ ਅੱਗੇ ਅ ਸਮਾਂ ਵੱਧਦਾ ਜਾ ਰਿਹਾ ਹੈ ਏ ਆਈ ਦੀ ਵੀ ਡਿਵਲੈਪਮੈਂਟ ਹੋ ਰਹੀ ਹੈ ਏ ਆਈ ਦੇ ਵਿੱਚ ਅ ਕਾਫੀ ਜ਼ਿਆਦਾ ਚੀਜ਼ਾਂ ਤੁਸੀਂ ਕੋਈ ਵੀ ਇੱਕ ਟੋਪਿਕ ਸਰਚ ਕਰਨਾ ਉਸੇ ਟਾਈਮ ਤੁਹਾਨੂੰ ਉਸ ਦੀ ਵੀਡੀਓ ਪ੍ਰੈਜੈਂਟੇਸ਼ਨ ਗ੍ਰਾਫ ਵਗੈਰਾ ਆਦਿ ਬਣ ਕੇ ਆ ਜਾਂਦੇ ਹਨ ਜਿਸ ਨਾਲ ਕੀ ਵਿਦਿਆਰਥੀਆਂ ਨੂੰ ਆਪਣਾ ਪ੍ਰੀਖਿਆਵਾਂ ਜਿਹੜੀਆਂ ਹੈ ਉਹਨਾਂ ਨੂੰ ਦੇਣ ਵਿੱਚ ਬਹੁਤ ਹੀ ਮਦਦ ਹੁੰਦੀ ਹੈ ਅਤੇ ਬਾਕੀ ਅ ਬ ਬੱਚੇ ਅੱਜ ਕੱਲ੍ਹ ਦੇ ਇੱਦਾਂ ਦੇ ਹੁੰਦੇ ਹਨ ਵੀ ਕਿਤਾਬਾਂ ਨੂੰ ਤਾਂ ਉਹਨਾਂ ਨੇ ਹੱਥ ਨਹੀਂ ਲਗਾਉਣਾ ਬਟ ਮੋਬਾਇਲ ਫੋਨ 'ਤੇ ਵੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਉਹਨਾਂ ਨੂੰ ਸਿੱਖਣਯੋਗ ਮਿਲਦੀਆਂ ਹਨ